ਸਾਡੇ ਪਿੰਡ ਵਿੱਚ ਡਾਂਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਭੰਗੜਾ ਪਾ ਕੇ ਜਾਂ ਐਕਸਸਾਈਜ਼ ਦੇ ਲਈ ਡਾਂਸ ਕਰਦੇ ਹਨ ਕਿਉਂਕਿ ਇਸ ਨਾਲ ਬੰਦਾ ਵਧੀਆ ਤਰੀਕੇ ਨਾਲ ਫਿੱਟ ਵੀ ਹੋ ਸਕਦਾ ਹੈ ਅਤੇ ਆਪਣੀ ਖੁਸ਼ੀ ਜ਼ਾਹਿਰ ਵੀ ਕਰ ਸਕਦਾ ਹੈ